ਮੈਨੂੰ ਚਿੱਤਰਕਾਰੀ ਕਰਨ ਦਾ ਵੈਸੇ ਤਾਂ ਬਹੁਤ ਸ਼ੌਕ ਆ ਅਤੇ ਵੈਸੇ ਮੈਂ ਇਹ ਜਿਹੜਾ ਕੰਮ ਆ ਜਿਵੇਂ ਕੋਈ ਆਉਂਦਾ ਹੈ ਤਾਂ ਮੈਂ ਉਸ ਹਿਸਾਬ ਨਾਲ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਜੇ ਲੈਮੀਨੇਸ਼ਨ ਕਰਨਾ ਤਾਂ ਲੈਮੀਨੇਸ਼ਨ ਕਰਦੀ ਹਾਂ ਜੇ ਫਰੇਮ ਦੇ ਵਿੱਚ ਜੜਨਾ ਫਰੇਮ ਦੇ ਵਿੱਚ ਵੀ ਜੜ ਦਿੰਦੀ ਹਾਂ ਉਹ ਜਿਵੇਂ ਕਹਿੰਦੇ ਨੇ ਉਵੇਂ ਕਰੀਦਾ ਹੁੰਦਾ ਹੈ ਅਤੇ ਬਾਕੀ ਜੇ ਮੈਨੂੰ ਆਪਣੇ ਚਿ ਚਿੱਤਰਾਂ ਨੂੰ ਸੰਭਾਲ ਕੇ ਰੱਖਣਾ ਹੋਵੇ ਤਾਂ ਮੈਂ ਜ਼ਿਆਦਾਤਰ ਲੈਮੀਨੇਸ਼ਨ ਕਰਕੇ ਜਾਂ ਪੋਸਟਰ ਬਣਾ ਕੇ ਹੀ ਉਹਨਾਂ ਨੂੰ ਸੰਭਾਲ ਕੇ ਰੱਖਦੀ ਹਾਂ ਇਹ ਇੱਕ ਕਿਸਮ ਨਾਲ ਮੇਰੇ ਲਈ ਮੇਰੀ ਕਮਾਈ ਦਾ ਜ਼ਰੀਆ ਹੈ ਇਹਦੇ ਨਾਲ ਰੋਜ਼ਗਾਰ ਜਿਵੇਂ ਮੈਨੂੰ ਹੁੰਦਾ ਹੈ ਉਹ ਕੰਮ ਕਰਦੀ ਹਾਂ